ਮੈਨੂੰ ਭਾਰਤੀ ਫ਼ਿਲਮਾਂ ਬਹੁਤ ਵਧੀਆ ਲੱਗਦੀਆਂ ਹਨ ਪਰ ਫ਼ਿਲਮਾਂ ਉਹ ਵਧੀਆ ਲੱਗਦੀਆਂ ਹਨ ਜਿਹੜੀਆਂ ਆਪਾਂ ਆਪਣੇ ਪਰਿਵਾਰ ਵਿੱਚ ਸਾਰੇ ਇਕੱਠੇ ਬੈਠ ਕੇ ਦੇਖ ਸਕੀਏ ਬੱਚਿਆਂ ਨੂੰ ਕੁਛ ਸਿੱਖਣ ਨੂੰ ਮਿਲੇ ਵੱਡਿਆਂ ਨੂੰ ਕੁਛ ਸਿੱਖਣ ਨੂੰ ਮਿਲੇ ਉਸੇ ਤਰ੍ਹਾਂ ਆਪਣਾ ਭਾਰਤੀ ਸੰਗੀਤ ਸਭ ਤੋਂ ਵਧੀਆ ਸੰਗੀਤ ਹੈ ਮਨ ਨੂੰ ਸ਼ਾਂਤੀ ਦਿੰਦਾ ਹੈ ਔਰ ਸੰਗੀਤ ਤਾਂ ਵੈਸੇ ਵੀ ਘਰ ਸਾਰਾ ਦਿਨ ਚੱਲਦਾ ਰਹੇ ਆਪਾਂ ਨੂੰ ਬਹੁਤ ਵਧੀਆ ਲੱਗਦਾ ਚੰਗਾ ਲੱਗਦਾ ਆਪਣੇ ਮਨ ਨੂੰ ਔਰ ਫ਼ਿਲਮਾਂ ਮੈਂ ਹਰ ਤਰ੍ਹਾਂ ਦੀਆਂ ਦੇਖਦੀ ਹਾਂ ਰੋਮੈਂਟਿਕ ਫਿਲਮਾਂ ਡਰਾਮਾ ਫਿਲਮਾਂ ਥਰੀਲਰ ਫਿਲਮਾਂ ਔਰ ਜੇ ਆਪਾਂ ਪਿਛਲੇ ਟਾਈਮ ਦੀ ਗੱਲ ਕਰੀਏ ਤਾਂ ਧਰਮਿੰਦਰ ਜੀ ਮੇਰੇ ਪਸੰਦੀਦਾ ਅਦਾਕਾਰ ਨੇ ਉਨ੍ਹਾਂ ਦੇ ਨਾਲ ਹੀ ਮੈਨੂੰ ਹੇਮਾ ਮਾਲਿਨੀ ਜੀ ਬਹੁਤ ਪਸੰਦ ਨੇ ਔਰ ਅਗਰ ਅੱਜ ਦੀ ਗੱਲ ਕਰੀਏ ਤਾਂ ਮੈਨੂੰ ਸ਼ਾਹਰੁਖ ਖਾਨ ਬਹੁਤ ਚੰਗੇ ਲੱਗਦੇ ਨੇ ਅਤੇ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਜੀ ਬਹੁਤ ਵਧੀਆ ਲੱਗਦੇ ਨੇ ਔਰ ਗੀਤ ਹਰ ਤਰ੍ਹਾਂ ਦੇ ਵਧੀਆ ਲੱਗਦੇ ਨੇ ਕਿਉਂਕਿ ਆਪਣੇ ਭਾਰਤੀ ਸੰਗੀਤ ਦੇ ਵਿੱਚ ਹਰ ਮੌਕੇ ਦੇ ਗੀਤ ਬਣੇ ਹੋਏ ਨੇ ਜਿਨ੍ਹਾਂ ਨੂੰ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਔਰ ਲੇਡੀਜ਼ ਦਾ ਤਾਂ ਵੈਸੇ ਵੀ ਹੁੰਦਾ ਹੈ ਅੱਜ ਕੱਲ੍ਹ ਕੰਮ ਕਰਦੇ ਕਰਦੇ ਸੰਗੀਤ ਲਗਾ ਲੈਂਦੀਆਂ ਨੇ ਇੱਕ ਐਂਏ ਲੱਗਦਾ ਸਾਨੂੰ ਕਿ ਸਾਡਾ ਕੰਮ ਬਹੁਤ ਜਲਦੀ ਹੋ ਜਾਂਦਾ ਹੈ ਗੀਤ ਚਲਦੇ ਰਹਿਣ ਗੀਤ ਮਨ ਨੂੰ ਸ਼ਾਂਤੀ ਖੁਸ਼ੀ ਦਿੰਦੇ ਨੇ ਹਰ ਤਰ੍ਹਾਂ ਦੇ ਗੀਤ ਵਧੀਆ ਲੱਗਦੇ ਨੇ ਔਰ ਆਪਣੇ ਪੰਜਾਬੀ ਦੇ ਵਿੱਚ ਮੈਨੂੰ ਗੁਰਦਾਸ ਮਾਨ ਜੀ ਦੇ ਗਾਣੇ ਬਹੁਤ ਜ਼ਿਆਦਾ ਪਸੰਦ ਨੇ ਮੈਂ ਗੁਰਦਾਸ ਮਾਨ ਜੀ ਦੇ ਗਾਣੇ ਬਹੁਤ ਸੁਣਦੀ ਹਾਂ ਔਰ ਹਿੰਦੀ ਸੰਗੀਤ ਦੇ ਵਿੱਚ ਮੈਨੂੰ ਉਦਿੱਤ ਨਾਰਾਇਣ ਜੀ ਦੇ ਗਾਣੇ ਬਹੁਤ ਪਸੰਦ ਹਨ ਮੈਂ ਪੁਰਾਣੇ ਗਾਣੇ ਵੀ ਬਹੁਤ ਸੁਣਦੀ ਹਾਂ ਅਤੇ ਅੱਜ ਦੇ ਗਾਣੇ ਵੀ ਬਹੁਤ ਵਧੀਆ ਲੱਗਦੇ ਨੇ ਗੇ ਭਾਰਤੀ ਸੰਗੀਤ ਦੀ ਤਾਂ ਗੱਲ ਹੀ ਵੱਖਰੀ ਹੈ ਮਨ ਨੂੰ ਸ਼ਾਂਤੀ ਦਿੰਦਾ ਬਹੁਤ ਵਧੀਆ ਲੱਗਦੇ ਨੇ